ਪੰਜਾਬ ਵਿੱਚ ਅਨੁਭਵ ਕਰਨ ਨੂੰ ਬਹੁਤ ਕੁਛ ਹੈ ਪੰਜਾਬ ਦੀ ਸੁ ਸੁੰਦਰਤਾ ਦਾ ਕੀ ਵਰਣਨ ਕਰਾਂ ਪੰਜਾਬ ਹਮੇਸ਼ਾ ਤੋਂ ਹੀ ਇੱਕ ਟੂਰਿਸਟ ਅਟਰੈਕਸ਼ਨ ਰਿਹਾ ਹੈ ਸਭ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਵਿੱਚ ਰੋਜ ਗਾਰਡਨ ਝਰਨਾ ਬਹੁਤ ਹੈ ਰੋਜ ਗਾਰਡਨ ਇੱਕ ਬਹੁਤ ਸੋਹਣਾ ਕੁਦਰਤੀ ਬਾਗ ਹੈ ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪੇੜ ਪੌਦੇ ਪੁਤਲੇ ਨੇ ਚੰਡੀਗੜ੍ਹ ਵਿੱਚ ਸੁਖਨਾ ਝੀਲ ਵੀ ਹੈ ਜੋ ਕਿ ਚੰਡੀਗੜ੍ਹ ਦੇ ਲੋਕਾਂ ਲਈ ਤਾਂ ਬਾ ਅਤੇ ਨਾਲੇ ਬਾਹਰੋਂ ਘੁੰਮਣ ਆਏ ਲੋਕਾਂ ਲਈ ਇੱਕ ਬਹੁਤ ਸੋਹਣਾ ਐਕਸਪੀਰੀਅੰਸ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਹਰ ਹਰ ਸ਼ਹਿਰ ਦਾ ਇੱਕ ਆਪਣਾ ਸਥੱਲ ਹੈ ਜਿਵੇਂ ਕਿ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਦਰਬਾਰ ਸਾਹਿਬ ਜਲੰਧਰ ਵਿੱਚ ਵੰਡਰਲੈਂਡ ਜਿੱਥੇ ਕਿ ਵੱਖ ਵੱਖ ਸਕੂਲ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਸਾਇੰਸ ਦੀਆਂ ਗੱਲਾਂ ਸਿੱਖਣ ਨੂੰ ਮਿਲਣ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਾ ਹੈ ਜੋ ਕਿ ਅੰਮ੍ਰਿਤਸਰ ਅਤੇ ਜਲੰਧਰ ਹਾਈਵੇ 'ਤੇ ਹੀ ਹੈ ਉਹ ਰੈਸਟੋਰੈਂਟ ਪਲੇਨ ਦੀ ਸ਼ੇਪ ਦਾ ਹੈ ਮਤਲਬ ਇੱਕ ਸੱਚਾ ਜ ਪਲੇਨ ਉੱਥੇ ਖੜ੍ਹਾ ਹੈ ਜਿਹਦੇ ਵਿੱਚ ਅਸੀਂ ਟਿਕਟ ਲੈ ਕੇ ਹੀ ਜਾਂਦੇ ਹਾਂ ਬਕਾਇਦਾ ਅ ਅੰਦਰਲੀਆਂ ਸੀਟਾਂ ਵੀ ਪਲੇਨ ਦੀ ਸੀਟਾਂ ਵਾਂਗੂੰ ਹਨ ਜਿਨ੍ਹਾਂ ਨੇ ਅੱਜ ਤੱਕ ਕਦੇ ਜਹਾਜ਼ ਵਿੱਚ ਬਹਿਣ ਦਾ ਅਨੁਭਵ ਨਹੀਂ ਕੀਤਾ ਉਹ ਉੱਥੇ ਜਾ ਕੇ ਰੋਟੀ ਖਾ ਕੇ ਇੱਕ ਅਜਿਹਾ ਵੱਖਰਾ ਅ ਅਨੁਭਵ ਕਰ ਸਕਦੇ ਹਨ ਧੰਨਵਾਦ